ਇੱਕ ਸੈਲਾਨੀ ਨੂੰ ਰੋਪੜ ਜ਼ਿਲ੍ਹੇ ਦੇ ਇਤਿਹਾਸਕ ਸਥਾਨ ਘੁੰਮਣ ਜਾਣ ਦਾ ਜਿਵੇਂ ਕਿ ਅਨੰਦਪੁਰ ਸਾਹਿਬ ਟਿੱਬੀ ਸਾਹਿਬ ਭੱਠਾ ਸਾਹਿਬ ਚਮਕੌਰ ਸਾਹਿਬ ਇਹਨਾਂ ਦਾ ਜਾਣ ਦਾ ਖਰਚਾ ਪੰਦਰਾਂ ਸੌ ਰੁਪਏ ਤੱਕ ਹੋ ਸਕਦਾ ਹੈ ਸੈਰ ਸਪਾਟਾ ਸਥਾਨ ਦਾ ਦੌਰਾ ਜਿਵੇਂ ਕਿ ਵੋਟ ਕਲੱਬ ਵਾਟਰ ਲੀਲੀ ਰਣਜੀਤ ਸਿੰਘ ਬਾਗ ਅਤੇ ਇਹਨਾਂ ਦਾ ਖਰਚਾ ਪੰਜਾਹ ਰੁਪਈਏ ਤੱਕ ਆ ਸਕਦਾ ਹੈ